ਮੈਨੂੰ ਪੇਂਟਿੰਗ ਦਾ ਬੜਾ ਸ਼ੌਕ ਹੈ ਅਤੇ ਮੈਂ ਜਦੋਂ ਵੀ ਕਿਤੇ ਵੀ ਘੁੰਮਣ ਜਾਂਦਾ ਹਾਂ ਤਾਂ ਮੈਂ ਉੱਥੇ ਇਮਾਰਤਾਂ ਪਹਾੜੀ ਇਲਾਕੇ ਝੀਲਾਂ ਇਹੋ ਜਿਹੀਆਂ ਚੀਜ਼ਾਂ ਦੀ ਪੇਂਟਿੰਗਾਂ ਕਰਦਾ ਹਾਂ ਅਤੇ ਮੈਨੂੰ ਸਭ ਤੋਂ ਵਧੀਆ ਲੱਗਦਾ ਹੈ ਝੀਲਾਂ ਅਤੇ ਪਹਾੜਾਂ ਦੀਆਂ ਪੇਂਟਿੰਗ ਕਰਨੀ ਅਤੇ ਮੈਂ ਜਦੋਂ ਵੀ ਕਿਸੇ ਪਹਾੜੀ ਇਲਾਕੇ ਵਿੱਚ ਜਾਂਦਾ ਜਾਂ ਫਿਰ ਉੱਥੇ ਕੋਈ ਝੀਲ ਹੁੰਦੀ ਹੈ ਤਾਂ ਮੈਂ ਉਹਦੀ ਪੇਂਟਿੰਗ ਜ਼ਰੂਰ ਕਰਦਾ ਹਾਂ ਕਿਉਂਕਿ ਮੈਂ ਜਦੋਂ ਇਹ ਪੇਂਟਿੰਗਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਆਪ ਕੁਦਰਤ ਨਾਲ ਜੁੜ ਰਿਹਾ ਹਾਂ ਅਤੇ ਜਦੋਂ ਮੈਂ ਪੇਂਟਿੰਗ ਕਰਦਾ ਹਾਂ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਮੈਨੂੰ ਅੰਦਰੋਂ ਅੰਦਰੋਂ ਸਕੂਨ ਮਿਲਦਾ ਹੈ ਜਦੋਂ ਮੈਂ ਪਹਾੜਾਂ ਦੀ ਪੇਂਟਿੰਗ ਕਰਦਾ ਜਦੋਂ ਮੈਂ ਪੇਂਟਿੰਗ ਕਰਦਾ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਮੈਂ ਆਪ ਹੀ ਪਹਾੜਾਂ ਦੇ ਵਿੱਚ ਬੈਠਾ ਹੋਵਾਂ ਅਤੇ ਬਾਅਦ 'ਚੋਂ ਇਹ ਜੋ ਵੀ ਪੇਂਟਿੰਗ ਨੇ ਉਹ ਮੈਂ ਆਨਲਾਈਨ ਸ਼ੇਅਰ ਵੀ ਕਰਦਾ ਅਤੇ ਜਦੋਂ ਲੋਕ ਬਹੁਤ ਵਧੀਆ ਵਧੀਆ ਕਮੈਂਟ ਕਰਦੇ ਨੇ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਕਿ ਮੈਂ ਕੁਦਰਤ ਨਾਲ ਜੁੜਦਾ ਹਾਂ ਅਤੇ ਇਸ ਤਰ੍ਹਾਂ ਲੋਕ ਵੀ ਕਮੈਂਟ ਕਰਦੇ ਹਨ ਕਿ ਉਹ ਮੇਰੀਆਂ ਪੇਂਟਿੰਗਸ ਦੇਖ ਕੇ ਉਹਨਾਂ ਨੂੰ ਇੱਕ ਬਹੁਤ ਕੁਦਰਤੀ ਫੀਲਿੰਗ ਆਉਂਦੀ ਹੈ ਅਤੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਹੈ ਇਸ ਲਈ ਮੇਰਾ ਮਨ ਪਸੰਦੀਦਾ ਵਿਸ਼ਾ ਕੁਦਰਤੀ ਪਹਾੜਾਂ ਅਤੇ ਝੀਲਾਂ ਦੀ ਪੇਂਟਿੰਗ ਕਰਨਾ ਹੈ